ਤੁਸੀਂ ਇੱਕ ਮੀਟਿੰਗ ਵਿੱਚ ਓ ਅਤੇ ਮਹਿਸੂਸ ਕਰਦੇ ਹੋ ਕਿ ਤੁਹਾਡਾ ਫੋਨ ਬੈਲੰਸ ਘੱਟ ਹੈ ਮਹੱਤਵਪੂਰਨ ਵਾਕ ਕਾਲ ਕਰਨ ਲਈ ਤੁਹਾਨੂੰ ਤੇਜ਼ੀ ਨਾਲ ਰੀਚਾਰਜ ਕਰਨ ਦੀ ਜਰੂਰਤ ਹੈ ਇਸ ਕਰਕੇ ਮੇਰਾ ਨੈੱਟ ਮੁੱਕ ਗਿਆ ਹੈ ਮੈਂ ਅੱਗੇ ਜਿਆਦਾ ਜਾਣਕਾਰੀ ਨਹੀਂ ਕਰ ਸਕਦਾ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਪੜਾਉਣਾ ਹੈ